ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਹੈ ਪੰਜਾਬੀ ਭਾਸ਼ਾ ਬਹੁਤ ਹੀ ਸੋਹਣੀ ਭਾਸ਼ਾ ਹੈ ਜੋ ਕਿ ਗੁਰਮੁਖੀ ਲਿਪੀ ਵਿੱਚ ਲਿਖੀ ਗਈ ਹੈ ਗੁਰੂਆਂ ਪੀਰਾਂ ਅਤੇ ਕਵੀਆਂ ਨੇ ਆਪਣੀਆਂ ਬਹੁਤ ਸਾਰੀਆਂ ਕਵਿਤਾਵਾਂ ਅਤੇ ਸਾਹਿਤ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਵਿੱਚ ਲਿਖਿਆ ਹੈ ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰਾ ਸਾਹਿਤ ਅਤੇ ਕਵਿਤਾਵਾਂ ਵਿੱਚ ਲਿਖਣ ਵਿੱਚ ਗੁਰੂਆਂ ਪੀਰਾਂ ਅਤੇ ਕਵੀਆਂ ਦਾ ਬੜਾ ਯੋਗਦਾਨ ਰਿਹਾ ਹੈ ਇਹਨਾਂ ਸਾਹਿਤ ਅਤੇ ਕਵਿਤਾਵਾਂ ਨੂੰ ਲਿਖਣ ਵਿੱਚ ਇਹਨਾਂ ਨੇ ਬੜੇ ਹੀ ਸੋਹਣੇ ਢੰਗ ਨਾਲ ਉਸ ਕਵਿਤਾਵਾਂ ਨੂੰ ਅਤੇ ਉਸ ਸਹਿਤ ਨੂੰ ਸਜਾਇਆ ਹੈ ਇੱਕ ਉਸ ਕਵਿਤਾਵਾਂ ਵਿੱਚ ਇਹਨਾਂ ਨੇ ਹਰ ਹਰ ਪੱਖ ਦੀ ਹਰ ਚੀਜ਼ ਦਾ ਵਰ ਵਰਨਣ ਉਸ ਵਿੱਚ ਕੀਤਾ ਹੈ ਜਿਵੇਂ ਕਿ ਪੇੜ ਪੌਦਿਆਂ ਦਾ ਬਹੁਤ ਸੋਹਣੇ ਤਰੀਕੇ ਨਾਲ ਉਸ ਵਿੱਚ ਦੋਹੜੇ ਦਾ ਛੰਦਾਂ ਦਾ ਦੋਹੜੇ ਦਾ ਅਖਾਣਾਂ ਦਾ ਮੁਹਾਵਰਿਆਂ ਦਾ ਬੜਾ ਸੋਹਣੇ ਤਰੀਕੇ ਨਾਲ ਉਸਨੂੰ ਇੱਕ ਇੱਕ ਸ਼ਬਦ ਨੂੰ ਸਜਾ ਕੇ ਉਸਦੇ ਸਹਿਤ ਨੂੰ ਸੋਹਣਾ ਬਣਾਇਆ ਹੈ ਪੰਜਾਬੀ ਸਾਹਿਤ ਵਿੱਚ ਕਵੀਆਂ ਦੀ ਲਿਖੀ ਹੋਈ ਕਵਿਤਾਵਾਂ ਬਹੁਤ ਹੀ ਸੋਹਣੀਆਂ ਹਨ ਅਤੇ ਉਹਨਾਂ ਨੇ ਉਸ ਇਸ ਪੰਜਾਬੀ ਭਾਸ਼ਾ ਦਾ ਮਾਣ ਬਹੁਤ ਵਧਾ ਦਿੱਤਾ ਹੈ ਕਿਉਂਕਿ ਪੰਜਾਬੀ ਭਾਸ਼ਾ ਵਿੱਚ ਗੁਰੂ ਪੀਰਾਂ ਸਾਹਿਬਾਨਾਂ ਅਤੇ ਕਵੀਆਂ ਦੀਆਂ ਲਿਖੀਆਂ ਹੋਈਆਂ ਕਵਿਤਾ ਜਿਸ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਐਵੇਂ ਲੱਗਦਾ ਹੈ ਕਿ ਅਸੀਂ ਸੱਚ ਮੁੱਚ ਉਸ ਜ ਜ਼ਿੰਦਗੀ ਨੂੰ ਜੀਅ ਰਹੇ ਹਾਂ ਉਸ ਕਵਿਤਾ ਵਿੱਚ ਜੀਅ ਰਹੇ ਹਾਂ ਇਸ ਤਰ੍ਹਾ ਉਹਨਾਂ ਨੇ ਉਸ ਨੂੰ ਇੱਕ ਬਹੁਤ ਬਹੁਤ ਸੋਹਣਾ ਵਰਨਣ ਕਰਕੇ ਸਾਨੂੰ ਸਾਨੂੰ ਬਹੁਤ ਸੋਹਣਾ ਵਰਨਣ ਕਰਕੇ ਦਿੱਤਾ ਹੈ